ਬਹੁਤੇ ਸ਼ੁਰੂਆਤੀ ਸਿੱਖਿਅਕ ਬਹੁਤ ਛੋਟੇ ਬੱਚਿਆਂ ਨਾਲ਼ ਪੇਂਟਿੰਗ ਨੂੰ ਮਹੱਤਵ ਦਿੰਦੇ ਹਨ ਕਿਸੇ ਵੀ ਸੁਰੱਖਿਆ ਕਾਰਕ ਜਿਵੇਂ ਕਿ ਗੈਰ ਜ਼ਹਿਰੀਲੀ ਸਮੱਗਰੀ ਅਤੇ ਬਿਨਾਂ ਸੱਟ ਦੇ ਪ੍ਰਕਿਰਿਆਂ ਦਾ ਅਨੁਭਵ ਕਰਨ ਦੀ ਯੋਗਤਾ 'ਤੇ ਵਿਚਾਰ ਕਰਨਾ ਮਹੱਤਵਪੂਰਨ ਹੈ ਇੱਥੋਂ ਤੱਕ ਕੇ ਬਹੁਤ ਛੋਟੇ ਬੱਚੇ ਵੀ ਆਪਣੀਆਂ ਉਂਗਲਾਂ ਨੂੰ ਪੇਂਟ ਮਿਸ਼ਰਨ ਵਿੱਚ ਡੁਬੋ ਸਕਦੇ ਹਨ ਅਤੇ ਉਸ ਨੂੰ ਮੇਜ਼ ਜਾਂ ਟ੍ਰੇਅ 'ਤੇ ਫੈਲਾ ਸਕਦੇ ਹਨ ਬ ਬੱਚੇ ਬਹੁਤ ਸਾਰੇ ਕਨੈਕਸ਼ਨ ਅਤੇ ਵਿਚਾਰ ਬਣਾਉਂਦੇ ਹਨ ਕਿ ਪੇਂਟਿੰਗ ਪ੍ਰਕਿਰਿਆ ਉਹਨਾਂ ਲਈ ਕਿਵੇਂ ਕੰਮ ਕਰਦੀ ਹੈ ਨਾਲ਼ ਹੀ ਉਹ ਇਸ ਬਾਰੇ ਕੀ ਅਨੰਦ ਲੈਂਦੇ ਹਨ ਇੱਕ ਬੱਚੇ ਦੀ ਪੇਂਟਿੰਗ ਦੇਖੋ ਅਤੇ ਤੁਸੀਂ ਇੱਕ ਪੂਰੀ ਤਰ੍ਹਾਂ ਰੁੱਝੇ ਹੋਏ ਬੱਚੇ ਨੂੰ ਦੇਖੋ ਅਸੀਂ ਲੱਗਭਗ ਬੱਚਿਆਂ ਦੇ ਵਿਚਾਰਾਂ ਨੂੰ ਦੇਖ ਸਕਦੇ ਹਾਂ ਜਿਵੇਂ ਕਿ ਜਦੋਂ ਮੈਂ ਆਪਣੇ ਬੁਰਸ਼ ਨੂੰ ਫਲੈਟ ਕਰਦਾ ਹਾਂ ਤਾਂ ਮੇਰੀ ਲਾਈਨ ਵੱਡੀ ਹੋ ਜਾਂਦੀ ਹੈ ਜਾਂ ਮੈਨੂੰ ਇਸ ਨੂੰ ਹਿਲਾਉਣਾ ਪਸੰਦ ਹੈ ਪਰ ਮੈਂ ਇਸ ਨੂੰ ਕਾਗਜ਼ 'ਤੇ ਨਹੀਂ ਰੱਖਣਾ ਚਾਹੁੰਦਾ ਜਾਂ ਇਸ ਨੂੰ ਛੂਹਣਾ ਨਹੀਂ ਚਾਹੁੰਦਾ ਜਾਂ ਮੈਂ ਹੋਰ ਲਾਲ ਅਤੇ ਸੰਤਰੀ ਨਾਲ਼ ਲਾਲ ਮਿਲਾਇਆ ਅਤੇ ਅੱਗ ਦਾ ਰੰਗ ਲਾਲ ਹੋ ਗਿਆ ਜਦੋਂ ਅਸੀਂ ਸੁਣਦੇ ਅਤੇ ਦੇਖਦੇ ਹਾਂ ਤਾਂ ਅਸੀਂ ਇਹ ਸਮਝਣਾ ਸ਼ੁਰੂ ਕਰ ਸਕਦੇ ਹਾਂ ਕਿ ਇੱਕ ਬੱਚਾ ਆਪਣੇ ਸੰਸਾਰ ਨੂੰ ਕਿਵੇਂ ਸਮਝਦਾ ਹੈ ਉਸ ਦੀਆਂ ਵਿਕਾਸ ਦੀਆਂ ਕਾਬਲੀਅਤਾਂ ਅਤੇ ਉਸ ਦੀਆਂ ਲੋੜਾਂ ਜਾਂ ਰੁਚੀਆਂ